ਬਾਰ੍ਹਾਂ ਜਨਵਰੀ ਵੀਹ ਸੌ ਬਾਰ੍ਹਾਂ ਸਤਾਰਾਂ ਅਗਸਤ ਵੀਹ ਸੌ ਪੰਦਰਾਂ ਅਠਾਈ ਦਸੰਬਰ ਵੀਹ ਸੌ ਤੇਈ ਇੱਕੀ ਜਨਵਰੀ ਦੋ ਹਜ਼ਾਰ ਦਸ ਜਨਵਰੀ ਉੱਨੀ ਸੌ ਬਾਨ੍ਹਵੇਂ